ਸਾਡੇ ਸ਼ਹਿਰ ਵਿੱਚ ਬਹੁਤ ਹੀ ਮਸ਼ਹੂਰ ਮੋਲ ਬਣਿਆ ਹੋਇਆ ਹੈ ਜਿਸ ਦਾ ਨਾਮ ਵੀ ਆਰ ਪੰਜਾਬ ਮੋਲ ਹੈ ਸਾਨੂੰ ਇਹ ਘਰ ਤੋਂ ਬਹੁਤ ਹੀ ਨੇੜੇ ਪੈਂਦਾ ਹੈ ਜਦੋਂ ਵੀ ਕੋਈ ਪ੍ਰੋਗਰਾਮ ਹੋਵੇ ਜਾਂ ਕਿਸੇ ਦਾ ਜਨਮ ਦਿਨ ਹੋਵੇ ਤਾਂ ਅਸੀਂ ਮੋਲ ਵਿੱਚ ਚਲੇ ਜਾਂਦੇ ਹਾਂ ਕਿਉਂਕਿ ਉੱਥੇ ਖਾਣ ਪੀਣ ਦੀਆਂ ਬਹੁਤ ਹੀ ਜ਼ਿਆਦਾ ਦੁਕਾਨਾਂ ਹਨ ਹਰ ਕਿਸਮ ਦੀ ਦੁਕਾਨ ਹੈ ਜਿਸ ਦਾ ਜੋ ਮਨ ਹੋਵੇ ਖਾ ਸਕਦਾ ਹੈ ਇਸ ਤੋਂ ਇਲਾਵਾ ਮਨੋਰੰਜਨ ਲਈ ਉੱਥੇ ਫੰਨ ਸਿਟੀ ਬਣੀ ਹੋਈ ਹੈ ਜਿੱਥੇ ਜਾ ਕੇ ਗੇਮਾਂ ਖੇਡ ਸਕਦੇ ਹਾਂ ਅਤੇ ਆਪਣਾ ਮਨੋਰੰਜਨ ਕਰ ਸਕਦੇ ਹਾਂ ਇਸ ਤੋਂ ਇਲਾਵਾ ਪੀ ਵੀ ਆਰ ਵਿੱਚ ਫਿਲਮਾਂ ਵੀ ਵੇਖ ਸਕਦੇ ਹਾਂ ਉੱਥੇ ਘੁੰਮਣ ਲਈ ਬਹੁਤ ਹੀ ਵਧੀਆ ਜਗ੍ਹਾ ਹੈ ਇਸ ਤੋਂ ਇਲਾਵਾ ਸ਼ੋਪਿੰਗ ਕਰਨ ਲਈ ਬਹੁਤ ਹੀ ਸ਼ੋਅਰੂਮ ਬਣੇ ਹੋਏ ਹਨ